ਮੈਂ ਅਤੇ ਮੇਰੇ ਚਾਰ ਦੋਸਤ ਅਸੀਂ ਚਾਰਾਂ ਨੇ ਡਿਸਾਈਡ ਕੀਤਾ ਵੀ ਅਸੀਂ ਬਾਈਕ 'ਤੇ ਟੂਰ ਕਰਨਾ ਮੇਰੇ ਕੋਲ ਸੀਗਾ ਸੀ ਡੀ ਡੀਲਕਸ ਨੰਬਰ ਉਹਦਾ ਪੀ ਬੀ ਸੱਠ ਏ ਤਰਵੰਜਾ ਵੀਹ ਮੈਂ ਅਤੇ ਮੇਰੇ ਦੋਸਤਾਂ ਨੇ ਡਿਸਾਈਡ ਕੀਤਾ ਅਸੀਂ ਘਰੋਂ ਬਾਈਕ ਲਏ ਆਪਣੇ ਆਪਣੇ ਸਾਰੇ ਬਾਈਕ 'ਤੇ ਚੱਲੇ ਬਾਈਕ ਦੇ ਨਾਲ ਅਸੀਂ ਜੋ ਜੋ ਸਾਨੂੰ ਲੋੜੀਂਦਾ ਸਮਾਨ ਸੀ ਅਸੀਂ ਨਾਲ ਲਿਆ ਉਹਦੇ ਵਿੱਚ ਜਿਵੇਂ ਸਾਡਾ ਜ਼ਰੂਰੀ ਆ ਸਮਾਨ ਸੀ ਕੱਪੜੇ ਕੋਈ ਖਾਣੇ ਦਾ ਸਮਾਨ ਈਵਨ ਕਿ ਬਾਈਕ ਦੇ ਖਿਆਲ ਵਾਸਤੇ ਵੀ ਅਸੀਂ ਇੱਕ ਟਿਊਬ ਬਾਈਕ ਦੀ ਔਰ ਉਸ ਦੇ ਇਲਾਵਾ ਇੱਕ ਹਵਾ ਵਾਲਾ ਪੰਪ ਤਾਂ ਜੋ ਸਾਨੂੰ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਫਿਰ ਅਸੀਂ ਡਿਸਾਈਡ ਕੀਤਾ ਵੀ ਅਸੀਂ ਜਦੋਂ ਸਾਡਾ ਟੂਰ ਲੰਬਾ ਹੋਣ ਕਰਕੇ ਅਸੀਂ ਜਿਹੜਾ ਕਿਲੋਮੀਟਰ ਦੇ ਅਕੋਰਡਿੰਗ ਰੈਸਟ ਕਰਨ ਦਾ ਡਿਸਾਈਡ ਕੀਤਾ ਸੀ ਅਸੀਂ ਘੱਟੋ ਘੱਟ ਡੇਲੀ ਦਾ ਸੌ ਕਿਲੋਮੀਟਰ ਕਰਨ ਤੋਂ ਬਾਅਦ ਘੰਟਾ ਕੁ ਅਸੀਂ ਕਿਸੇ ਰੈਸਟ ਹਾਊਸ ਅਤੇ ਜਾਂ ਕੋਈ ਆਪਣੇ ਸਰਾਂ ਵਗੈਰਾ 'ਤੇ ਜਾ ਕੇ ਰੈਸਟ ਕਰਦੇ ਸੀ ਅਤੇ ਉਸ ਤੋਂ ਬਾਅਦ ਅਗਲੀ ਜਿਹੜੀ ਯਾਤਰਾ ਸੀ ਸਾਡੀ ਅਸੀਂ ਤੈਅ ਕਰਦੇ ਸੀ ਅਤੇ ਇਸ ਕੰਮ ਵਿੱਚ ਸਾਨੂੰ ਲੱਗਾ ਤਕਰੀਬਨ ਤਿੰਨ ਦਿਨ ਦਾ ਸਾਡਾ ਟੂਰ ਸੀ ਅਸੀਂ ਟੂਰ ਨੂੰ ਤਿੰਨ ਦਿਨ ਸਮੇਂ ਦੇ ਦੌਰਾਨ ਹੀ ਪੂਰਾ ਕਰ ਲਿਆ ਜਿਹੜੀ ਗੱਲ ਆਪਣੇ ਸਮਾਂ ਕੱਢ ਕੇ ਕੰਮ ਕੰਮ ਦੇ ਵਿੱਚੋਂ ਕੰਮ ਸਮਾਂ ਕੱਢ ਕੇ ਆਪਣੇ ਆਪ ਨੂੰ ਯੂਟੀਲਾਈਜ਼ ਕ ਕੀਤਾ ਜਾਂਦਾ